ਪੰਜਾਬੀ ਸੱਭਿਆਚਾਰ ਜਿਵੇਂ ਕਿ ਪੰਜਾਬੀ ਭਾਸ਼ਾ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਜਿਹੜੇ ਪੰਜਾਬੀ ਭਾਸ਼ਾ ਇਹ ਆਰੀਆ ਭਾਸ਼ਾ ਜੋ ਨਿਕਲ ਕੇ ਸਾਡੇ ਕੋਲ ਆਈ ਤਾਂ ਵੀ ਜਦੋਂ ਕੋਈ ਵੀ ਭਾਸ਼ਾ ਕਿਸੇ ਸਟੇਟ ਦਾ ਹਿੱਸਾ ਬਣ ਜਾਂਦੀ ਹੈ ਜਾਂ ਕਿਸੇ ਰਾਜ ਦਾ ਹਿੱਸਾ ਬਣ ਜਾਂਦੀ ਆ ਜਾਂ ਕਿਸੇ ਕਿੱਤੇ ਦਾ ਹਿੱਸਾ ਬਣ ਜਾਂਦੀ ਹੈ ਤਾਂ ਉਹ ਅੱਗੇ ਹੌਲੀ ਹੌਲੀ ਜਾ ਕੇ ਉਹ ਆਪਣਾ ਰੂਪ ਧਾਰਨ ਕਰ ਲੈਂਦੀ ਆ ਜਿਵੇਂ ਕਿ ਆਪਾਂ ਕਹਿੰਦੇ ਸੱਭਿਆਚਾਰ ਦੀ ਪਛਾਣ ਵਿੱਚ ਵੀ ਸੱਭਿਆਚਾਰ ਦੀ ਪਛਾਣ ਵਿੱਚ ਅਸੀਂ ਪੰਜਾਬੀ ਹਾਂ ਸਾਡਾ ਰਾਜ ਪੰਜਾਬ ਆ ਇਹ ਹੋਣ ਕਰਕੇ ਹੁਣ ਪੰਜਾਬੀ ਭਾਸ਼ਾ ਨੇ ਸਾਨੂੰ ਬਹੁਤ ਯੋਗਦਾਨ ਦਿੱਤਾ ਸ਼ੱਭਿਆ ਸੱਭਿਆਚਾਰ ਦੀ ਪਛਾਣ ਦੇ ਵਿੱਚ ਵੀ ਜਿਹੜੀ ਸਾਡੀ ਪੰਜਾਬੀ ਭਾਸ਼ਾ ਉਹ ਵੀ ਠੇਠ ਪੰਜਾਬੀ ਆ ਜਿਹਦੇ ਵਿੱਚ ਸੱਭਿਆਚਾਰ ਦੇ ਵਿੱਚ ਇਹ ਸਾਨੂੰ ਇੱਕ ਨਵੀਂ ਪਹਿਚਾਣ ਦਿੰਦੀ ਹੈ ਜਿਹਦੇ ਵਿੱਚ ਪੰਜਾਬੀ ਭਾਸ਼ਾ ਦੇ ਵਿੱਚ ਸੱਭਿਆਚਾਰ ਦੇ ਵਿੱਚ ਹੀ ਸਾਡਾ ਬਹੁਤ ਸਾਰਾ ਸਾਹਿਤ ਲਿਖਿਆ ਗਿਆ ਜਿਵੇਂ ਕਿ ਮੰਨ ਲਓ ਸੱਭਿਆਚਾਰ ਦੇ ਵਿੱਚ ਪਹਿਲਾਂ ਲੋਕਧਾਰਾ ਸੀ ਲੋਕਧਾਰਾ ਦੇ ਵਿੱਚ ਜਿੰਨੀਆਂ ਵੀ ਸਾਡੀਆਂ ਭਾਸ਼ਾਵਾਂ ਸੀ ਅਤੇ ਜਿਹੜੀ ਬੋਲੀ ਸੀ ਉਹ ਮੌਖਿਕ ਰੂਪ ਦੇ ਵਿੱਚ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਦੇ ਵਿੱਚ ਜਾਂਦੀ ਸੀ ਉਹ ਸਾਡੀ ਆਮ ਭਾਸ਼ਾ ਰਾਹੀਂ ਜਾਂਦੀ ਸੀ ਅਤੇ ਸੱਭਿਆਚਾਰ ਦੇ ਵਿੱਚ ਇਹ ਸਾਡੀ ਪੰਜਾਬੀ ਭਾਸ਼ਾ ਦੀ ਪਛਾਣ ਪਈ ਹੋਈ ਆ ਸਾਡੇ ਸੱਭਿਆਚਾਰ ਵਿੱਚ ਸਾਡੇ ਲੋਕਧਾਰਾ ਵਿੱਚ ਇਹ ਸਾਰਾ ਕੁਛ ਪਿਆ ਹੋਇਆ ਇਸ ਤੋਂ ਬਾਅਦ ਜਿਹੜੀ ਪੰਜਾਬੀ ਭਾਸ਼ਾ ਇਹ ਵੀ ਪੰਜਾਬੀ ਭਾਸ਼ਾ ਦੀ ਜਿਹੜੀ ਮਿਆਦ ਆ ਇਹਦੇ ਵਿੱਚ ਹੀ ਜਿੰਨੇ ਸਾਡੇ ਪੰਜਾਬ ਵਿੱਚ ਦਸ ਗੁਰੂ ਸਾਹਿਬਾਨ ਸੀਗੇ ਉਹਨਾਂ ਨੇ ਇਹ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਅਤੇ ਸੱਭਿਆਚਾਰ ਦਾ ਇੱਕ ਪਛਾਣ ਚਿੰਨ੍ਹ ਬਣਾਉਣ ਲਈ ਇਹਨੂੰ ਉੱਪਰ ਲਿਜਾਣ ਲਈ ਵੀ ਸੋਲ੍ਹਾਂ ਸੌ ਚਾਰ ਈਸਵੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਜਿਹੜੀ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੇ ਵੀ ਗੁਰੂ ਸਾਹਿਬਾਨਾਂ ਨੇ ਛੇ ਗੁਰੂ ਸਾਹਿਬਾਨਾਂ ਨੇ ਆਪਦੀਆਂ ਬਾਣੀਆਂ ਦਰਜ ਕੀਤੀਆਂ ਸੀ ਉਹਦੇ ਵਿੱਚ ਜਿਹੜੀ ਇਹ ਭਾਸ਼ਾ ਸੀ ਸਾਡੇ ਸੱਭਿਆਚਾਰ ਦੀ ਭਾਸ਼ਾ ਸੀ ਅਤੇ ਲੋਕਾਂ ਦੇ ਆਮ ਬੋਲ ਚਾਲ ਦੇ ਨੇੜੇ ਦੀ ਭਾਸ਼ਾ ਸੀ ਜਿਹਨੂੰ ਸਮਝਣਾ ਅਤੇ ਸੁਣਨਾ ਬਹੁਤ ਸੌਖਾ ਸੀ